ਹੈਲੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਆਪਣੇ ਕੋਲ ਜੀ ਦੇਖੋ ਏਵਨ ਐਟਲਸ ਔਰ ਹੀਰੋ ਸਾਈਕਲ ਹੈਗੇ ਨੇ ਜੀ ਆਪਣੇ ਕੋਲ ਅਵੇਲੇਬਲ ਤੁਹਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਜੀ ਹਾਂਜੀ ਆਪਣੇ ਕੋਲ ਬਿਨਾਂ ਛੋਕਰ ਤੋਂ ਵੀ ਹੈ ਔਰ ਵਿਦ ਛੋਕਰਸ ਵੀ ਆਉਂਦਾ ਹੈਗਾ ਜੀ ਗੇਅਰਸ ਵਾਲਾ ਵੀ ਆਉਂਦਾ ਹੈਗਾ ਅਤੇ ਬੱਚੇ ਨੂੰ ਕਿੰਨੇ ਕੁ ਮਤਲਬ ਕਿੰਨੇ ਇੰਚਸ ਵਾਲਾ ਚਾਹੀਦਾ ਤੁਸੀਂ ਉਹ ਵੀ ਦੱਸ ਦਿਉ ਜੀ ਮਤਲਬ ਮੈਂ ਸੌਲਾਂ ਇੰਚੀ ਆ ਅਠਾਰਾਂ ਇਸ ਤਰ੍ਹਾਂ ਨੇ ਵੀ ਹੁੰਦੇ ਨੇਗੇ ਅਤੇ ਤੁਸੀਂ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਦੇਖੋ ਜੀ ਜਿਹੜੇ ਛੋਕਰ ਵਾਲਾ ਉਹ ਸਿਕਸ ਥਾਊਜੈਂਡ ਤੱਕ ਹੈ ਜੀ ਔਰ ਜਿਹੜਾ ਵਿਦਆਊਟ ਛੋਕਰਸ ਆ ਫ਼ੋਰ ਥਾਊਜੈਂਡ ਦੀ ਰੇਂਜ ਦੇ ਵਿੱਚ ਹੈਗਾ ਇਹ ਹੈਗੇ ਜੀ ਐਟਲਸ ਦਾ

ਇਹ ਜੀ ਗੇਅਰ ਵਾਲਾ ਹੈਗਾ ਇਹ ਇਸ ਲਈ ਥੋੜ੍ਹੀ ਜਿਹੀ ਇਹਦੀ ਕੋਸਟ ਜ਼ਿਆਦਾ ਹੈਗੀ ਇਹਨੇ ਮਤਲਬ ਦੂਜੇ ਮਤਲਬ ਇਹਦੇ ਆਪਣੇ ਨੋਰਮਲ ਸਾਈਕਲਸ ਨੇ ਉਹਦੇ ਉਹਦੇ ਵਿੱਚ ਕੰਪੈਰੀਜ਼ਨ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹੈਗੇ ਕਿ ਉਹਦੇ ਉਹਦੇ ਉਹਦੇ ਮੁਤਾਬਿਕ ਥੋੜ੍ਹਾ ਜਿਹਾ ਇਹ ਮਹਿੰਗਾ ਹੁੰਦਾ ਹੈਗਾ ਹਾਂਜੀ ਕਲਰ ਦੇਖੋ ਉਹਦੇ ਵਿੱਚ ਜੀ ਰੈਡ ਵੀ ਇੱਕ ਬੱਚੇ ਯੂਜ ਕਰਦੇ ਹੈਗੇ ਬਲੈਕ ਵੀ ਹੈਗਾ ਬਰਾਉਨ ਵੀ ਹੈਗਾ ਹਰ ਕਲਰ ਦੇ ਹਰ ਰੰਗ ਦੇ ਵਿੱਚ ਮਤਲਬ ਇਹ ਆਪਣੇ ਕੋਲ ਉਪਲੱਬਧ ਹੈਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਮਤਲਬ ਜੇ ਬੱਚਾ ਛੋਟਾ ਜੇ ਬੱਚਾ ਦੇਖੋ ਥੋੜ੍ਹਾ ਵੱਡਾ ਹੈਗਾ ਤਾਂ ਉਹਨਾਂ ਨੇ ਉਹਦੇ ਲਈ ਕੋਈ ਉਹ ਨਹੀਂ ਹੈਗੀ ਮੁਸ਼ਕਿਲ ਵਾਲੀ ਗੱਲ ਪਰ ਜੇ ਛੋਟਾ ਬੱਚੇ ਨੂੰ ਤੁਸੀਂ ਬਿਠਾਉਣਾ ਹੈਗਾ ਤਾਂ ਉਹਦੇ ਲਈ ਸੀ ਜਿਹੜੀ ਉਹਦੀ ਸੀਟ ਦੀ ਸੁਵਿਧਾ ਹੈਗੀ ਉਹ ਵੀ ਉਪਲਬਧ ਹੈਗੀ ਆ ਆਪਣੇ ਉਹਦੇ ਵਿੱਚ ਸਾਈਕਲਸ ਦੇ ਵਿੱਚ ਉਹ ਤੁਸੀਂ ਇੱਦਾਂ ਕਰੋ ਜੀ ਮਤਲਬ ਇੱਕ ਵਾਰੀ ਤੁਸੀਂ ਦੁਕਾਨ 'ਤੇ ਆ ਜੋ ਆਪਣੇ ਕੋਲ ਸ਼ੋਪ 'ਤੇ ਆ ਜੋ ਇੱਕ ਵਾਰੀ ਆ ਕੇ ਆਪਾਂ ਗੱਲਬਾਤ ਕਰ ਲੈਦੇ ਹਾਂ ਬੈਠ ਕੇ ਜਿੱਦਾਂ ਤੁਹਾਨੂੰ ਠੀਕ ਲੱਗੇ ਤੁਸੀਂ ਬੱਚੇ ਨੂੰ ਦਿਖਾ ਦਿਓ ਅਤੇ ਉਹ ਆਪਾਂ ਦੇ ਕੇ ਮੈਂ ਤੁਹਾਨੂੰ ਤੇਰੇ ਕੋਲ ਇਹ ਆਪਣਾ ਵਟਸਐਪ ਨੰਬਰ 'ਤੇ ਹੋਏਗਾ ਜੀ ਵਾ ਤੁਸੀਂ ਮੈਨੂੰ ਆਪਣਾ ਵਟਸਐਪ ਨੰਬਰ ਭੇਜ ਦਿਓ ਮੈਂ ਤੁਹਾਨੂੰ ਉਹਦੇ ਆਪਣੀ ਫੋ ਅ ਸ਼ੋਪ ਦੀ ਲੋਕੈਸ਼ਨ ਭੇਜ ਦਿੰਦੇ ਹਾਂ ਜੀ ਹਾਂਜੀ ਹਾਂਜੀ ਹੋਰ ਕੋਈ ਅ ਹੋਰ ਕੋਈ ਸੇਵਾ ਹੈ ਜੀ ਦੱਸੋ ਹਾਂਜੀ ਹਾਂਜੀ ਦੁਕਾਨ ਖੁੱਲ੍ਹੀ ਹੋਏਗੀ ਜੀ ਹਾਂਜੀ ਹਾਂਜੀ ਖੁੱਲ੍ਹੀ ਹੋਏਗੀ ਜੀ ਹਾਂਜੀ ਬਿਲਕੁਲ ਜੀ ਇਹ ਅੱਠ ਵਜੇ ਤੱਕ ਜੀ ਸਵੇਰੇ ਨੌ ਤੋਂ ਨੌ ਤੋਂ ਅੱਠ ਜੀ ਹਾਂਜੀ ਹਾਂ ਓਕੇ ਜੀ